ਪ੍ਰਿਯ ਮਿੱਤਰ ਸੁਰੇਸ਼ ਮੈਂ ਬਹੁਤ ਜ਼ਿਆਦਾ ਉਤਸੁਕਤ ਉਤਸੁਕਤ ਹਾਂ ਕਿ ਅਸੀਂ ਦੋਵੇਂ ਜਾ ਕੇ ਮੁਫਾਸਾ ਦਾ ਲਾਇਨ ਕਿੰਗ ਫਿਲਮ ਚੌਦ੍ਹਾਂ ਫਰਵਰੀ ਨੂੰ ਵੇਖਾਂਗੇ ਕਿਉਂਕਿ ਚੌਦ੍ਹਾਂ ਫਰਵਰੀ ਨੂੰ ਉਹ ਰਿਲੀਜ਼ ਹੋਣੀ ਹੈ ਅਤੇ ਮੈਂ ਬਾਰ੍ਹਾਂ ਵਜੇ ਦਾ ਸ਼ੋਅ ਬੁੱਕ ਕਰਨ ਵੱਲੋਂ

ਤੂੰ ਆਪਣਾ ਦੇਖ ਲੈ ਕਿਉਂਕਿ ਬਾਰ੍ਹਾਂ ਵਜੇ ਤਾਂ ਠੀਕ ਹੀ ਲੱਗ ਰਿਹਾ ਮੈਨੂੰ